ਪਿਛਲੇ ਸਾਲਾਂ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਿਆ ਸ਼ੁਰੂਆਤ ਤੋਂ ਹੀ ਮੈਂ ਚੰਡੀਗੜ੍ਹ ਦੀ ਵਸਨੀਕ ਹੋਣ ਕਰਕੇ ਮੋਹਾਲੀ ਦੇ ਤੇ ਵਿੱਚ ਹੁੰਦੀ ਗਰੋਥ ਨੂੰ ਦੇਖਦੀ ਆਈ ਹਾਂ ਸ਼ੁਰੂਆਤ ਤੋਂ ਇੰਨੀ ਜ਼ਿਆਦਾ ਇੱਥੇ ਜਿਹੜੀ ਜਨਸੰਖਿਆ ਉਹ ਨਹੀਂ ਸੀ ਪਰ ਦਿਨਾਂ ਵਿੱਚ ਹੀ ਇੱਥੇ ਜਿਹੜੀ ਹੈ ਤਬਦੀਲੀ ਹੈ ਉਹ ਆਉਂਦੀ ਆਪਣੀ ਅੱਖੀਂ ਦੇਖੀ ਹੈ ਹੁਣ ਇਹ ਮੋਹਾਲੀ ਜ਼ਰੂਰੀ ਨਹੀਂ ਵੀ ਆਪਾਂ ਇਹ ਦੇਖੀਏ ਵੀ ਇੱਥੇ ਜਨਸੰਖਿਆ ਪਰ ਇੱਥੇ ਜਿਹੜੇ ਹੈ ਫੈਕਟਰੀਜ਼ ਜਾਂ ਹੋਰ ਆਰਥਿਕਤਾ ਦੇ ਪੱਖੋਂ ਇੱਥੇ ਕਾਫੀ ਜ਼ਿਆਦਾ ਤਰੱਕੀ ਹੋਈ ਹੈ ਪਰ ਇਸ ਦੇ ਨਾਲ ਨਾਲ ਇੱਕ ਗੱਲ ਇੱਥੋਂ ਦੀ ਇਹ ਵੀ ਇਹ ਨਾਂਹ ਪੱਖੀ ਮੈਂ ਕਹਿ ਸਕਦੀ ਹਾਂ ਵੀ ਇੱਥੇ ਮੋਹਾਲੀ ਦੇ ਵਿੱਚ ਜਿਹੜੇ ਬਾਹਰਲੇ ਸੂਬਿਆਂ ਤੋਂ ਬਹੁਤ ਜ਼ਿਆਦਾ ਉੱਥੋਂ ਦੇ ਵਸਿੰਦੇ ਨੇ ਉਹ ਇੱਥੇ ਆ ਕੇ ਵੱਸ ਗਏ ਨੇ ਜਿਨ੍ਹਾਂ ਕਰਕੇ ਇੱਕ ਤਾਂ ਇੱਥੇ ਭੀੜ ਭੜੱਕੇ ਵਾਲਾ ਜਿਹੜਾ ਜ਼ਿਆਦਾ ਮਾਹੌਲ ਹੋ ਗਿਆ ਦੂਸਰਾ ਇੱਥੇ ਜਿਹੜੇ ਕੁਕਰਮ ਨੇ ਉਹ ਵੱਧ ਗਏ ਤੀਜਾ ਜਿੰਨਾ ਮੋਹਾਲੀ ਪਿਛਲੇ ਦਿਨਾਂ ਵਿੱਚ ਸੇਫ ਸੀ ਓਨਾਂ ਹੁਣ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ